ਮੈਂ ਰਾਜਪ੍ਰੀਤ ਕੌਰ ਤੁਹਾਡੇ ਸਾਹਮਣੇ ਪੰਜਾਬੀ ਭਾਸ਼ਾ ਬਾਰੇ ਅਤੇ ਪੰਜਾਬੀ ਕਲਚਰ ਬਾਰੇ ਵੀ ਪੰਜਾਬੀ ਸੱਭਿਆਚਾਰ ਬਾਰੇ ਤੁਹਾਡੇ ਸਾਹਮਣੇ ਵਿਚਾਰ ਪੇਸ਼ ਕਰਨਾ ਚਾਹੁੰਦੀ ਹਾਂ ਅਤੇ ਜਿਹੜਾ ਆਪਣਾ ਪੰਜਾਬ ਵਿੱਚ ਭਾਰਤ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਉਹ ਬਹੁਤ ਹੀ ਉੱਚੇ ਪੱਧਰ 'ਤੇ ਹੈ ਇਸ ਨੂੰ ਕਈ ਥਾਵਾਂ 'ਤੇ ਬੋਲੀ ਜਾਂਦੀ ਹੈ ਕਈ ਖੇਤਰਾਂ ਦੇ ਵਿੱਚ ਬੋਲੀ ਜਾਂਦੀ ਹੈ ਪੰਜਾਬ ਦੇ ਪੰਜਾ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸ ਨੂੰ ਥੋੜ੍ਹੇ ਹਿੱਸਿਆਂ ਦੇ ਵਿੱਚ ਬੋਲਣ ਦੇ ਕਿਉਂਕਿ ਬਾਹਰਲੇ ਦੇਸ਼ ਵੀ ਪੰਜਾਬੀ ਭਾਸ਼ਾ ਨੂੰ ਬਹੁਤ ਲਾਈਕ ਕਰਦੇ ਆ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਆ ਕਿਉਂਕਿ ਆਪਣਾ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਸੱਭਿਆਚਾਰ ਨੂੰ ਬਹੁਤ ਪਸੰਦ ਕਰਦੇ ਕਿਉਂਕਿ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਬਹੁਤ ਹੀ ਉੱਚੇ ਪੱਧਰ 'ਤੇ ਗਿਣਿਆ ਗਿਆ ਹੈਗਾ ਅਤੇ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਇਸ ਵਿੱਚ ਬਹੁਤ ਹੀ ਪੰਜਾਬੀ ਗੀਤ ਗਿੱਧਾ ਭੰਗੜਾ ਲੁੱਡੀ ਇਹੋ ਜਿਹਾ ਕੁਝ ਫੰਕਸ਼ਨ ਆਦਿ ਇਹ ਸਭ ਕੁਝ ਜਿਹੜਾ ਫੰਕਸ਼ਨ ਆ ਕਰਵਾਇਆ ਜਾਂਦੇ ਹਨ ਇਹ ਆਏ ਸਾਲ ਹਰੇਕ ਕਾਲਜਾਂ ਸਕੂਲਾਂ ਦੇ ਵਿੱਚ ਕਰਵਾਏ ਜਾਂਦੇ ਹਨ ਇਹਨਾਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬਹੁਤ ਉਪਲਬਧ ਹੈ ਇਹਨਾਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬਹੁਤ ਹੀ ਉੱਚੇ ਪੱਧਰ 'ਤੇ ਗਿਣਿਆ ਗਿਆ ਹੈ ਕਿਉਂਕਿ ਜਿਹੜਾ ਪੰਜਾਬ ਦੀ ਭਾਸ਼ਾ ਹੈਗੀ ਉਹ ਕਈ ਹਿੱਸਿਆਂ ਦੇ ਵਿੱਚ ਜਦੋਂ ਮਾਝੇ ਵੱਲ ਜਾਂਦੇ ਹਨ ਤਾਂ ਉੱਧਰ ਵੀ ਥੋੜ੍ਹਾ ਜਾ ਕੇ ਮਾੜਾ ਫਰਕ ਪੈ ਜਾਂਦਾ ਹੈ ਦੁਆਬੇ ਵੱਲ ਜਾਂਦੇ ਹਾਂ ਤਾਂ ਵੀ ਥੋੜ੍ਹੀ ਜਿਹੀ ਬੋਲੀ ਦਾ ਫਰਕ ਪੈਂਦਾ ਹੈ ਤਾਂ ਪੰਜਾਬ ਦੇ ਵਿੱਚ ਰਹਿੰਦੇ ਜਿਹੜੇ ਪੰਜਾਬੀ ਬੋਲਦੇ ਨੇ ਉਹਨਾਂ ਨੂੰ ਵੀ ਪੰਜਾਬ ਦਾ ਬਹੁਤ ਮਾਣ ਹੈ ਆਪਣੇ ਆਪ 'ਤੇ ਵੀ ਪੰਜਾਬੀ ਹੋਣ 'ਤੇ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਿਹੜਾ ਪੰਜਾਬ ਆ ਪੰਜਾਬੀ ਕਲਚਰ ਹੈ ਸਾਰਾ ਇੰਨਾ ਵਧੀਆ ਹੈਗਾ ਸਾਰੇ ਉਸਨੂੰ ਇੰਨਾ ਵਧੀਆ ਸਮਝਦੇ ਹਨ ਕਿ ਜਿਹੜੇ ਬਾਹਰਲੇ ਲੋਕ ਆ ਉਹ ਵੀ ਪੰਜਾਬੀ ਸਿੱਖਣ ਦੇ ਕਈ ਵਾਰ ਕੋਸ਼ਿਸ਼ ਕਰਦੇ ਹਨ ਕਿ ਇੰਨਾ ਵਧੀਆ ਬੋਲਿਆ ਜਾਂਦਾ ਹੈ ਉਹ ਬੋਲ ਕੇ ਕਈ ਵਾਰ